ਸਤਿ ਸ਼੍ਰੀ ਅਕਾਲ ਜੀ ਅਸੀਂ ਕਾ ਅਸੀਂ ਰਿਵਾਈਤੀ ਕਾਗਜ਼ 'ਤੇ ਰਿਵਾਇਤੀ ਤੌਰ 'ਤੇ ਪੈਨ ਨਾਲ ਲਿਖਣਾ ਪਸੰਦ ਕਰਦੇ ਹਾਂ ਕਿਉਂਕਿ ਲੈਪਟੋਪ 'ਤੇ ਮੋਬਾਈਲ 'ਤੇ ਉਹ ਗੱਲਾਂ ਨਹੀਂ ਲਿਖੀਆਂ ਜਾ ਸਕਦੀਆਂ ਜੋ ਆਪਣੇ ਮਨ ਵਿੱਚ ਹੈ ਪਰ ਇਸ ਕਰਕੇ ਆਪਾਂ ਮੋਬ ਪੈਨ ਨਾਲ ਹੀ ਉਹ ਗੱਲਾਂ ਲਿਖ ਸਕਦੇ ਹਾਂ ਜੋ ਆਪਣੇ ਅੰਦਰ ਹੁੰਦੀਆਂ ਹਨ